ਤੁਸੀਂ ਸਵੀਗੀ ਤੋਂ ਗੱਲ ਕਰਦੇ ਹੋ ਮੈਂ ਤੁਹਾਡੇ ਤੋਂ ਬਹੁਤ ਸਾਰਾ ਖਾਣਾ ਅੱਜ ਮੰਗਵਾਇਆ ਸੀ ਪਰ ਤੁਸੀਂ ਮੇਰਾ ਖਾਣਾ ਜਿਵੇਂ ਕਿ ਪੀਜ਼ ਪੰਦਰਾਂ ਪੀਜ਼ਾ ਅੱਠ ਕੋਕ ਅਤੇ ਪੰਦਰਾਂ ਬਰਗਰ ਦਸ ਫਰੈਂਚ ਫਰਾਈਜ਼ ਇਹ ਸਭ ਖਾਣਾ ਮੈਂ ਆਪਦੇ ਬਰਥਡੇ ਪਾਰਟੀ ਦੇ ਕਾਰਨ ਮੰਗਵਾਇਆ ਸੀ ਪਰ ਇਹ ਸਭ ਖਾਣਾ ਤੁਸੀਂ ਬਹੁਤ ਹੀ ਲੇਟ ਡਿਲੀਵਰ ਕੀਤਾ ਜਿਸ ਕਾਰਨ ਮੇਰੇ ਸਾਰੇ ਦੋਸਤ ਉਸ ਤੋਂ ਪਹਿਲਾਂ ਬਿਨਾਂ ਖਾਏ ਹੀ ਚਲੇ ਗਏ ਅਤੇ ਮੇਰੀ ਬਹੁਤ ਬੇਇੱਜ਼ਤੀ ਹੋਈ ਮੈਨੂੰ ਇਹ ਇਹ ਉਮੀਦ ਬਿਲਕੁਲ ਨਹੀਂ ਸੀ ਕਿ ਤੁਸੀਂ ਇੰਨੀ ਲੇਟ ਜਿਹੜਾ ਖਾਣਾ ਦਿਓ ਡਿਲੀਵਰ ਕਰੋਗੇ ਮੈਂ ਸੋਚਿਆ ਸੀ ਵੀ ਸਵੀਗੀ ਬਹੁਤ ਹੀ ਫਾਸਟ ਸਰਵਿਸ ਦਿੰਦਾ ਹੈ ਜਿਸ ਕਰਕੇ ਮੈਂ ਤੁਹਾਡੇ ਤੋਂ ਖਾਣਾ ਮੰਗਵਾਉਣ ਦਾ ਸੋਚਿਆ ਅਤੇ ਮੈਂ ਖਾਣਾ ਆਰਡਰ ਕਰਨ ਤੋਂ ਬਾਅਦ ਤੁਸੀਂ ਕਿਹਾ ਸੀ ਕਿ ਸੱਠ ਮਿੰਟ ਦੇ ਵਿੱਚ ਵਿੱਚ ਖਾਣਾ ਆ ਜਾਏਗਾ ਪਰ ਸੱਠ ਮਿੰਟ ਦੀ ਬਜਾਏ ਉਹ ਤਾਂ ਤਿੰਨ ਘੰਟੇ ਬਾਅਦ ਆਇਆ ਇਸ ਤੋਂ ਬਾਅਦ ਨਾ ਤਾਂ ਮੈਂ ਖਾ ਸਕੀ ਅਤੇ ਨਾ ਮੇਰੇ ਦੋਸਤ ਖਾ ਸਕੇ ਖਾਣਾ ਨਾ ਤਾਂ ਚੱਜ ਦੀ ਕੁਆਲਿਟੀ ਦਾ ਸੀ ਕਿਉਂਕਿ ਉਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਾ ਮੰਗਵਾਈਆਂ ਹੋਈਆਂ ਵੀ ਸੀ ਜਿਵੇਂ ਕਿ ਅੱਠ ਕੋਕ ਦੀ ਬਜਾਏ ਤੁਸੀਂ ਅੱਠ ਪੈਪਸੀ ਭੇਜ ਦਿੱਤੀਆਂ ਜੋ ਕਿ ਮੈਂ ਆਰਡਰ ਹੀ ਨਹੀਂ ਕੀਤੀਆਂ ਸੀ ਪੰਦਰਾਂ ਬਰਗਰ ਦੀ ਬਜਾਏ ਤੁਸੀਂ ਅਠਾਰਾਂ ਬਰਗਰ ਭੇਜ ਦਿੱਤੇ ਬਿੱਲ ਵੀ ਬਿਲਕੁਲ ਸਹੀ ਨਹੀਂ ਬਣਾਇਆ ਗਿਆ ਸੀ ਬਿੱਲ ਵਿੱਚ ਜ਼ਿਆਦਾ ਤੋਂ ਜ਼ਿਆਦਾ ਪੈਸੇ ਵੱਧ ਭਰੇ ਹੋਏ ਸੀ ਪੈਸੇ ਸੀਗੇ ਜਿਸ ਕਾਰਨ ਨਾ ਤਾਂ ਮੇਰਾ ਇਹ ਇਹ ਸਹੀ ਰਿਹਾ ਇਹ ਸਹੀ ਰਿਹਾ ਇਸ ਕਰਕੇ ਮੈਂ ਤਾਂ ਤੁਹਾਡੇ ਤੋਂ ਕਦੇ ਵੀ ਖਾਣਾ ਨਹੀਂ ਮੰਗਵਾਉਂਗੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਅੱਗੇ ਤੋਂ ਖਾਣਾ ਮੰਗਵਾਵਾਂ ਤਾਂ ਤੁਸੀਂ ਆਪਦਾ ਬਿੱਲ ਸਹੀ ਕਰਕੇ ਭੇਜੋ ਅਤੇ ਅੱਗੇ ਤੋਂ ਸਰਵਿਸ ਤੇਜ਼ ਭੇਜਿਆ ਕਰੋ ਧੰਨਵਾਦ